ਹਾਂਜੀ ਮੇਰੇ ਕੋਲ ਡੈਬਿਟ ਕਾਰਡ ਹੈ ਜੋ ਕਿ ਐਸ ਬੀ ਆਈ ਬੈਂਕ ਦਾ ਹੈ ਜਿਸ ਦਾ ਭੁਗਤਾਨ ਮੈਂ ਜਦੋਂ ਸ਼ੋਪਿੰਗ ਕਰਦੀ ਹਾਂ ਉਦੋਂ ਪੈਸੇ ਕਢਵਾਉਣ ਲਈ ਕਰਦੀ ਹਾਂ ਮੈਂ ਏ ਟੀ ਐਮ ਦੇ ਵਿੱਚ ਜਾ ਕੇ ਆਪਣਾ ਡੈਬਿਟ ਕਾਰਡ ਯੂਜ ਕਰਕੇ ਉੱਥੋਂ ਪੈਸੇ ਕਢਵਾਉਂਦੀ ਹਾਂ ਅਤੇ ਜਿਹੜੀ ਦੁਕਾਨ ਤੋਂ ਮੈਂ ਖਰੀਦਦਾਰੀ ਕਰਦੀ ਹਾਂ ਤਾਂ ਉੱਥੇ ਉਹਨਾਂ ਪੈਸਿਆਂ ਦਾ ਮੈਂ ਭੁਗਤਾਨ ਕਰਦੀ ਹਾਂ ਮੇਰੇ ਕੋਲ ਇੱਕ ਕ੍ਰੈਡਿਟ ਕਾਰਡ ਵੀ ਹੈ ਜਿਸ ਦਾ ਭੁਗਤਾਨ ਮੈਂ ਜਦੋਂ ਡੀ ਮੋਲ ਵਗੈਰਾ ਵਿੱਚ ਸ਼ੋਪਿੰਗ ਕਰਨ ਜਾਂਦੀ ਹਾਂ ਤਾਂ ਉਸ ਕ੍ਰੈਡਿਟ ਕਾਰਡ ਦੀ ਮੈਂ ਵਰਤੋਂ ਕਰਦੀ ਹਾਂ ਜਦੋਂ ਮੈਂ ਕੋਈ ਚੀਜ਼ਾਂ ਲੈਣ ਜਾਂਦੀ ਹਾਂ ਫਨਾਂਸ ਦੀਆਂ ਦੁਕਾਨਾਂ ਦੇ ਉੱਤੇ ਤਾਂ ਮੈਂ ਉੱਥੇ ਵੀ ਆਪਣੇ ਡੈਬਿਟ ਕਾਰਡ ਦਾ ਇਸਤੇਮਾਲ ਕਰਦੀ ਹਾਂ ਇਹ ਮੇਰੀ ਲੈਣ ਦੇਣ ਦੇ ਵਿੱਚ ਇਸ ਤਰ੍ਹਾਂ ਮਦਦ ਕਰਦੇ ਹਨ ਕਿ ਮੈਨੂੰ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਪੈਸੇ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕਾਰਡ ਦੇ ਨਾਲ ਹੀ ਆਰਾਮ ਨਾਲ ਪੇਮੈਂਟ ਕਰ ਸਕਦੀ ਹਾਂ ਅਤੇ ਸੁਰੱਖਿਅਤ ਤਰੀਕੇ ਨਾਲ ਕਰ ਸਕਦੀ ਹਾਂ ਮੇਰੇ ਪੈਸੇ ਡਿੱਗਣ ਗਵਾਚਣ ਆਦਿ ਦਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਸਰਕਾਰ ਨੇ ਇਹ ਬਹੁਤ ਵਧੀਆ ਅਭਿਆਨ ਚਲਾਇਆ ਹੈ ਇਹ ਸਾਨੂੰ ਇਹਨਾਂ ਕਾਰਡਾਂ ਦੀ ਵਰਤੋਂ ਕਰਦੇ ਹੋਏ ਕਈ ਤਰ੍ਹਾਂ ਦੀ ਸਿੱਖਿਆ ਮਿਲਦੀ ਹੈ ਕਈ ਤਰ੍ਹਾਂ ਦੀ ਨੌਲੇਜ ਮਿਲਦੀ ਹੈ ਅਤੇ ਔਨਲਾਈਨ ਪੇਮੈਂਟ ਕਰਨ ਦੇ ਨਾਲ ਸਾਡੇ ਪੈਸੇ ਵੀ ਸੇਵ ਰਹਿੰਦੇ ਨੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਹਾਂ ਇੱਥੇ ਲੁੱਟਾਂ ਖੋਹਾਂ ਚੋਰੀਆਂ ਚਕਾਰੀਆਂ ਬਹੁਤ ਹੁੰਦੀਆਂ ਹਨ ਅਗਰ ਬਾਈ ਚਾਂਸ ਤੁਹਾਡਾ ਕਾਰਡ ਕਿਤੇ ਗਿਰ ਜਾਂਦਾ ਹੈ ਤਾਂ ਤੁਸੀਂ ਬੈਂਕ ਨੂੰ ਫੋਨ ਕਰਕੇ ਆਪਣਾ ਕਾਰਡ ਤੁਰੰਤ ਬੰਦ ਕਰਾ ਸਕਦੇ ਹੋ ਤੁਹਾਡੇ ਕਾਰਡ ਦੇ ਵਿੱਚੋਂ ਕੋਈ ਵੀ ਪੇਮੈਂਟ ਜਿਹੜਾ ਹੈ ਕਿ ਨਹੀਂ ਕੱਢ ਸਕਦਾ ਇਸ ਕਰਕੇ ਹਰ ਜਗ੍ਹਾ 'ਤੇ ਹਰ ਇਨਸਾਨ ਨੂੰ ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ ਕ੍ਰੈਡਿਟ ਕਾਰਡ ਦਾ ਭੁਗਤਾਨ ਚਾਲੀ ਦਿਨਾਂ ਦੇ ਅੰਦਰ ਅੰਦਰ ਵਾਪਸ ਪੇਮੈਂਟ ਪਾ ਕੇ ਕਰਨਾ ਹੁੰਦਾ ਹੈ ਜੋ ਕਿ ਅਸੀਂ ਵਰਤਣ ਤੋਂ ਚਾਲੀ ਦਿਨਾਂ ਦੇ ਅੰਦਰ ਅੰਦਰ ਉਹ ਪੇਮੈਂਟ ਪਾ ਦਿੰਦੇ ਹਾਂ ਤਾਂ ਸਾਡਾ ਕ੍ਰੈਡਿਟ ਕਾਰਡ ਚਾਲੀ ਦਿਨਾਂ ਲਈ ਫਿਰ ਅੱਗੋਂ ਐਕਸਟੈਂਡ ਹੋ ਜਾਂਦਾ ਹੈ ਅਤੇ ਇਹ ਬਹੁਤ ਵਧੀਆ ਤਰੀਕਾ ਹੈ ਭੁਗਤਾਨ ਕਰਨ ਦਾ